ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਉਹ ਵੀ ਧਾਰਮਿਕ ਮੈਂ ਸ਼੍ਰੀ ਗੁਰੂ ਰਾਮਦਾਸ ਲਾਇਬਰੇਰੀ ਜੋ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੈ ਉਥੇ ਮੈਂ ਤਕਰੀਬਨ ਹਫ਼ਤੇ 'ਚ ਦੋ ਤਿੰਨ ਦਿਨ ਜਾਂਦਾ ਵਾ ਉਥੋਂ ਧਾਰਮਿਕ ਕਿਤਾਬਾਂ ਦੀ ਪੂਰੀ ਕੋਖ ਪੜਤਾਲ ਕਰਕੇ ਪੜ੍ਹ ਕੇ ਜੋ ਵੀ ਗਿਆਨ ਪ੍ਰਾਪਤ ਹੁੰਦਾ ਹੈ ਉਹ ਸਿੱਖ ਕੌਮ ਬਾਰੇ ਸਿੱਖ ਧਰਮ ਬਾਰੇ ਮੈਂ ਸਾਰਾ ਜਾਣਨਾ ਚਾਹੁੰਦਾ ਹਾਂ ਉਹਨਾਂ ਵਿੱਚ ਧਰਮ ਬਾਰੇ ਸਾਡੇ ਜਿੰਨੇ ਵੀ ਯੋਧੇ ਨੇ ਸੂਰਵੀਰ ਯੋਧੇ ਉਹਨਾਂ ਦੀਆਂ ਗੁਰੂ ਸਾਹਿਬਾਨ ਦੀਆਂ ਉਹ ਧਾਰਮਿਕ ਲਿਟਰੇਚਰ ਜਿਹੜਾ ਵੀ ਹੈਗਾ ਉਹ ਸਾਰਾ ਉੱਥੇ ਮੌਜੂਦ ਹੁੰਦਾ ਉੱਥੇ ਪੜ੍ਹ ਕੇ ਮੈਂ ਚਾਹੁੰਦਾ ਵਾਂ ਕਿ ਮੈਂ ਘਰ ਵੀ ਕੋਈ ਲਾਇਬਰੇਰੀ ਨਿੱਜੀ ਬਣਾਵਾਂ ਆਪਣੀ ਪਰ ਉਹਦੇ ਵਿੱਚ ਵਿਚਾਰ ਆਉਂਦਾ ਬੜਾ ਪਰ ਕੋਈ ਗੱਲ ਬਣਦੀ ਨਹੀਂ ਪਈ ਪਰ ਉਥੋਂ ਵੀ ਸਾਰਾ ਜੋ ਵੀ ਮੈਨੂੰ ਲਾਭ ਪ੍ਰਾਪਤ ਹੁੰਦਾ ਪੜਨ ਦਾ ਧਾਰਮਿਕ ਗ੍ਰੰਥਾਂ ਦਾ ਧਾਰਮਿਕ ਪੋਥੀਆਂ ਦਾ ਉਹ ਸਾਰਾ ਮੈਂ